ਹਾਂ ਮੇਰੀ ਮਨਪਸੰਦ ਖੇਡ ਬੈਡਮਿੰਟਨ ਹੈ ਮੇਰੇ ਅਸੀਂ ਆਪਣੇ ਰੋਜ਼ ਸ਼ਾਮ ਨੂੰ ਜਾ ਕੇ ਮੈਂ ਆਪਣੇ ਭਰਾ ਨਾਲ ਅਤੇ ਹੋਰ ਗੁਆਂਢੀਆਂ ਨਾਲ ਬੈਡਮਿੰਟਨ ਖੇਡਦਾ ਹਾਂ ਅਤੇ ਅਸੀਂ ਇੱਕ ਗਰਾਊਂਡ ਤਿਆਰ ਕੀਤਾ ਹੋਇਆ ਹੈ ਜਿਸ ਵਿੱਚ ਸਫਾਈ ਰੱਖੀ ਰੱਖੀ ਜਾਂਦੀ ਹੈ ਅਤੇ ਉੱਥੇ ਨੈੱਟ ਵਗੈਰਾ ਲਗਾ ਕੇ ਸ਼ਾਮ ਨੂੰ ਗੇਮ ਲੱਗਦੀ ਹੈ ਇਸ ਨਾਲ ਸਿਹਤ ਠੀਕ ਰਹਿੰਦੀ ਹੈ ਇੱਕ ਤਾਂ ਇੱਕ ਦਿਮਾਗ 'ਤੇ ਜਿਹੜਾ ਬੋਝ ਹੁੰਦਾ ਹੈ ਉਹ ਲਹਿ ਜਾਂਦਾ ਏ ਅਤੇ ਇਸ ਨਾਲ ਸਿਹ ਬਿਮਾਰੀ ਨਹੀਂ ਲੱਗਦੀ ਕੋਈ ਸਿਹਤ ਨੂੰ ਅਤੇ ਸਮਾਂ ਵੀ ਕਾਫੀ ਚੰਗਾ ਬੀਤਦਾ ਏ ਇਸ ਤਰ੍ਹਾਂ ਕਰਨ ਨਾਲ ਕੀ ਹੁੰਦਾ ਹੈ ਵੀ ਸਾਡੇ ਜਿਹੜੇ ਬੱਚੇ ਹੈ ਉਹ ਵੀ ਸਾਨੂੰ ਦੇਖਦੇ ਹੈ ਜ਼ਿਆਦਾਤਰ ਉਹ ਮੋਬਾਈਲਾਂ ਅਤੇ ਆਪਣੇ ਟੀ ਵੀ ਤੋਂ ਦੂਰ ਰਹਿੰਦੇ ਹੈ ਅਤੇ ਉਹ ਵੀ ਉਹਨਾਂ ਦਾ ਵੀ ਉਤਸ਼ਾਹ ਹੁੰਦਾ ਹੈ ਵੀ ਅਸੀਂ ਵੀ ਬਾਹਰ ਜਾ ਕੇ ਖੇਡੀਏ ਇਸ ਲਈ ਸਾਨੂੰ ਇਹ ਚੀਜ਼ਾਂ ਆਪਣੀ ਜ਼ਿੰਦਗੀ ਵਿੱਚ ਅਪਣਾਉਣੀਆਂ ਚਾਹੀਦੀਆਂ ਏ ਕਿ ਆਪਾਂ ਵੱਧ ਤੋਂ ਵੱਧ ਗਰਾਊਂਡ ਵਿੱਚ ਜਾਈਏ ਅਤੇ ਖੇਡਾਂ ਖੇਡੀਏ ਤਾਂ ਜੋ ਬੱਚਿਆਂ ਨੂੰ ਅਤੇ ਆਪਣੀ ਅਤੇ ਆਪਣੀ ਆਪ ਦੀ ਸਿਹਤ ਨੂੰ ਵੀ ਠੀਕ ਰੱਖਿਆ ਜਾਵੇ